ਸੱਤ ਜੁਲਾਈ ਉੱਨੀ ਸੌ ਸਤਾਨਵੇਂ ਬਾਰ੍ਹਾਂ ਅਗਸਤ ਉੱਨੀ ਸੌ ਤ੍ਰਿਆਨਵੇਂ ਇੱਕੀ ਅਕਤੂਬਰ ਉੱਨੀ ਸੌ ਚੁਰਾਨਵੇਂ ਸੋਲ੍ਹਾਂ ਅਕਤੂਬਰ ਉੱਨੀ ਸੌ ਤ੍ਰਿਆਨਵੇਂ ਇੱਕੀ ਨਵੰਬਰ ਦੋ ਹਜ਼ਾਰ ਇੱਕੀ